ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਤੁਸੀਂ ਪਾਵਰ ਜਿੰਮ ਸੈਂਟਰ ਤੋਂ ਬੋਲਦੇ ਅੱਛਾ ਜੀ ਹਾਂਜੀ ਨਾ ਮੈਨੂੰ ਤੁਹਾਡੇ ਬਾਰੇ ਦੱਸਿਆ ਸੀਗਾ ਅਤੇ ਮੈਨੂੰ ਥੋੜ੍ਹੀ ਜਿਹੀ ਨਾ ਵੀ ਆਪਣੇ ਬੋਡੀ ਬਾਰੇ ਮੈਂ ਤੁਹਾਡੀ ਤੋਂ ਵੀ ਹੁਬ ਲੈਣਾ ਫਿਟਨੈਸ ਦੀ ਲੈਣੀ ਸੀਗੀ ਅਤੇ ਮੈਨੂੰ ਨਾ ਮੇਰੀ ਇੱਕ ਲੱਤ ਬਹੁਤ ਦੁਖਦੀ ਹੈ ਅਤੇ ਸਰਵਾਈਕਲ ਦੀ ਪ੍ਰੋਬਲਮ ਹੈਗੀ ਬੀਪੀ ਵੀ ਵੱਧ ਜਾਂਦਾ ਹੈਗਾ ਅਤੇ ਮੈਨੂੰ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਜਾਣੂ ਕਰਾਉਗੇ

ਹਾਂਜੀ ਹਾਂਜੀ

ਮੈਮ ਕੰਮ ਤਾਂ ਹੁੰਦਾ ਨਹੀਂ ਨਾ ਲੱਤ ਦੀ ਪ੍ਰੋਬਲਮ ਕਰਕੇ ਇਸ ਕਰਕੇ ਜਿੰਮ ਜੁਆਇਨ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਮੈਨੂੰ ਓ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਜਿਹੜੇ ਪਾਵਰ ਜਿੰਮ ਸੈਂਟਰ ਵਾਲੇ ਨੇ ਉੱਥੇ ਜਾਂਦੀ ਸੀਗੀ ਮੈਨੂੰ ਬਹੁਤ ਫਰਕ ਪੈ ਗਿਆ ਉੱਥੇ ਜਾਣ ਨਾਲ ਤੇ ਮੈਂ ਤਾਂ ਹੀ ਮੈਂ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਹਾਂ ਵੀ ਵੀ ਜਿੰਮ ਦਾ ਕੋਈ ਟਾਈਮ ਹੋਵੇ ਹੈ ਨਾ ਮੈਮ ਐਂ ਆ ਨਾ ਕੰਮ ਦੇ ਨਾਲ ਨਾਲ ਫਿਰ ਦੇਖਣਾ ਪੈਂਦਾ ਵੀ ਇੱਕ ਸਾਨੂੰ ਵੀ ਕਿਹੜਾ ਟਾਈਮ ਸਹੀ ਹੁੰਦਾ ਬੱਚੇ ਵੀ ਤੋਰ ਹੁੰਦੇ ਆ ਸਕੂਲ ਅਸੀਂ ਹੈ ਨਾ ਅਤੇ ਬੱਚਿਆਂ ਨੇ ਆਉਣਾ ਹੁੰਦਾ ਖਾਣਾ ਵਗੈਰਾ ਦੇਣਾ ਹੁੰਦਾ ਅੱਛਾ ਮੈਂ ਨਾ ਦਵਾਈਆਂ ਵੀ ਬਹੁਤ ਖਾ ਖਾ ਕੇ ਦੇਖ ਲਈਆਂ ਅਤੇ ਦਵਾਈਆਂ ਨਾਲ ਅੱਛਾ ਜੀ ਅਤੇ ਜਿਹੜੇ ਆਪਣੇ ਗੋਡੇ ਵਗੈਰਾ ਦੁੱਖਦੇ ਹੁੰਦੇ ਉਹ ਵੀ ਸਹੀ ਹੋ ਜਾਂਦੇ ਆ ਅਤੇ ਏਜ਼ ਦਾ ਤਾਂ ਨਹੀਂ ਕੋਈ ਫਰਕ ਹੁੰਦਾ ਜਿਮ ਦੇ ਵਿੱਚ ਅੱਛਾ ਅੱਛਾ ਜੀ ਹਾਂਜੀ ਮੈਂਖਾਂ ਸੈਰ ਵਗੈਰਾ ਤਾਂ ਬਹੁਤ ਕਰਦੇ ਆਂਗੇ

ਹਾਂਜੀ ਹਾਂ ਹਾਂਜੀ ਫਿਰ ਤਾਂ ਕਹਿ ਦਿੰਦੇ ਵੀ ਤੁਸੀਂ ਸੈਰ ਨਹੀਂ ਕਰਦੇ ਤੁਸੀਂ ਬੈਠੇ ਹੁਣ ਘਰ ਦਾ ਕੰਮ ਕਰਦੇ ਆ ਘਰ ਦੇ ਕੰਮ ਦੇ ਨਾਲ ਨਾਲ ਅਸੀਂ ਸੈਰ ਵੀ ਕਰਦੇ ਹਾਂ ਹੈ ਨਾ ਅਤੇ ਫਿਰ ਵੀ ਕਹਿੰਦੇ ਤੁਸੀਂ ਤੁਸੀਂ ਸੁਬਾਹ ਵੀ ਸੈਰ ਕਰੋ ਸ਼ਾਮ ਨੂੰ ਵੀ ਸੈਰ ਕਰੋ ਕੋਈ ਇੰਨਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਅਤੇ ਬਾਕੀ ਹਾਂਜੀ ਅਤੇ ਬਾਕੀ ਮੈਂ ਦੇਖਦੀ ਹਾਂ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀ ਫਿਰ ਮੈਂ ਉਹਦੇ ਕੋਲ ਉਹਨੂੰ ਵੀ ਨਾਲ ਲੈ ਕੇ ਆਉਂਗੀ ਤੁਹਾਡੇ ਕੋਲ ਅਤੇ ਹਾਂਜੀ ਉਹ ਕਹਿੰਦੀ ਸੀ ਮੈਂ ਜਿੰਮ ਹਾਂਜੀ ਉਹ ਕਹਿੰਦੀ ਸੀਗੀ ਜਿੱਥੇ ਮੈਂ ਵੀ ਆਪਾਂ ਕਰਦੀ ਸੀ ਜਾ ਕੇ ਜਿੰਮ ਜੁਆਇੰਨ ਕਰਦੀ ਸੀ ਹੁਣ ਵੀ ਉੱਥੇ ਲੈ ਕੇ ਜਾਊਂਗੀ ਮੈਂ ਹਾਂ ਚੱਲ ਲੈ ਜੀ ਹੈ ਨਾ ਸਰੀਰ ਨੂੰ ਫਰਕ ਪੈਣਾ ਚਾਹੀਦਾ ਹੈਗਾ ਹਾਂਜੀ ਚਲੋ ਠੀਕ ਹੈ ਜੀ ਮੈਮ ਤੁਸੀਂ ਮੈਨੂੰ ਟਾਈਮ ਦਿੱਤਾ ਓਕੇ ਹੈ ਨਾ ਧੰਨਵਾਦ ਥੈਂਕ ਯੂ ਓਕੇ ਓਕੇ ਓਕੇ